ਨਮਸਕਾਰ ਜੀ ਮੇਰਾ ਨਾਮ ਸ਼ਸ਼ੀ ਹੈ ਅਤੇ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਇਸਲਾਮਾਬਾਦ ਮੁਹੱਲੇ ਦੀ ਅਤੇ ਅੱਜ ਜਿਵੇਂ ਮੈਂ ਆਪਣੇ ਘਰ ਦੇ ਜਿਵੇਂ ਟਾਈਮ ਦੇ ਵਿੱਚੋਂ ਹੀ ਆਪਣਾ ਥੋੜ੍ਹਾ ਬਹੁਤਾ ਕੰਮ ਸਿਲਾਈ ਜਾਂ ਬੁਣਾਈ ਦੇ ਵਿੱਚ ਵੀ ਆਪਣਾ ਥੋੜ੍ਹਾ ਜਿਹਾ ਟਾਈਮ ਕੱਢਦੀ ਹਾਂ ਅਤੇ ਸਵੇਰ ਸਾਰ ਜਿਵੇਂ ਅਸੀਂ ਬਥੇਰੀ ਸਵੇਰ ਤੋਂ ਸਾਡੀ ਭੱਜ ਦੌੜ ਸ਼ੁਰੂ ਹੋ ਜਾਂਦੀ ਆ ਵੀ ਜਿੱਦਾਂ ਬੱਚਿਆਂ ਨੂੰ ਨਾਸ਼ਤਾ ਦੇਣਾ ਹਸਬੈਂਡ ਦਾ ਖਾਣਾ ਬਣਾਉਣਾ ਟਿਫਨ ਪੈਕ ਕਰਨੇ ਉਹਨਾਂ ਦੇ ਹੋਰ ਸਿਲਾਈ ਬਣਾ ਆਪਣੀ ਮਤ ਕਿ ਅ ਘਰ ਦੇ ਕੰਮ ਕਈ ਹੁੰਦੇ ਨੇ ਉਹਨਾਂ ਨੂੰ ਨਿਪਟਾਉਂਦੇ ਕਈ ਹੋਏ ਨਿਪਟਾ ਕੇ ਫਿਰ ਅਸੀਂ ਆਪਣੇ ਨੈਦਮ ਜਦੋਂ ਕੋਈ ਮੈਨੂੰ ਸੂਟ ਸਾਟ ਵਗੈਰਾ ਸਿਉਣ ਵਾਸਤੇ ਆ ਜਾਂਦਾ ਹੈ ਤਾਂ ਫਿਰ ਮੈਂ ਥੋੜ੍ਹੀ ਦੇਰ ਲਈ ਮਸ਼ੀਨ 'ਤੇ ਆਪਣਾ ਕੰਮ ਕਰਦੀ ਹਾਂ ਮਸ਼ੀਨ ਦਾ ਕੰਮ ਪਹਿਲਾਂ ਜਿਵੇਂ ਅਸੀਂ ਮੈਂ ਆਪਣੇ ਸੂਟਾਂ ਨੂੰ ਕੱਟਿੰਗ ਕਰਕੇ ਰੱਖ ਲੈਂਦੀ ਹਾਂ ਅਤੇ ਫਿਰ ਟਾਈਮ ਲੱਗੇ ਤਾਂ ਫਿਰ ਟਾਈਮ ਲੱਗਦਾ ਹੈ ਤਾਂ ਫਿਰ ਮੈਂ ਕਦੀ ਆਪਣੇ ਸਲਵਾਰ ਨੂੰ ਖੜ੍ਹੇ ਕਰਕੇ ਮੈਂ ਕਿ ਉਹਨਾਂ ਦੇ ਪੌਂਚੇ ਪੁੰਚੇ ਬਣਾ ਲੈਂਦੀ ਕਿਸੇ ਦਿਨ ਫਿਰ ਟਾਈਮ ਲਗਦਾ ਸ਼ਾਮ ਨੂੰ ਮੈਂ ਫਿਰ ਕਮੀਜ਼ਾਂ ਤਿਆਰ ਕਰ ਲੈਂਦੀ ਹਾਂ ਅਤੇ ਕਈ ਵਾਰੀ ਹੁੰਦਾ ਵੀ ਕਈ ਵਾਰੀ ਕੰਮ ਨਹੀਂ ਵੀ ਆਉਂਦਾ ਵੀ ਸਿਲਾਈ ਦਾ ਘੱਟ ਹੀ ਆਉਂਦਾ ਆ ਅਤੇ ਫਿਰ ਉਦੋਂ ਸਰਦੀਆਂ ਦੇ ਮੌਸਮ ਵਿੱਚ ਮੈਂ ਥੋੜ੍ਹਾ ਬਹੁਤ ਆਪਣਾ ਬੁਣਾਈ ਦਾ ਕੰਮ ਕਰ ਲੈਂਦੀ ਹਾਂ ਵੀ ਜਿਵੇਂ ਉਹ ਛੋਟ ਛੋਟੀਆਂ ਜੁਰਾਬਾਂ ਹੋ ਗਈਆਂ ਬਣਾਉਣੀਆਂ ਟੋਪੀਆਂ ਹੋ ਗਈਆਂ ਠਾਕੁਰ ਜੀ ਦੇ ਸਰਦੀਆਂ ਵਾਲੇ ਬਸਤਰ ਬਣਾਉਣੇ ਅਤੇ ਹੋ ਰਿਹਾ ਤਾਂ ਜਦੋਂ ਨਵੇਂ ਨਵੇਂ ਡਿਜ਼ਾਇਨ ਦੇ ਜਿਵੇਂ ਲੋਕ ਕਈ ਤਰ੍ਹਾਂ ਦੇ ਡਿਮਾਂਡਾਂ ਕਰਦੇ ਆ ਵੀ ਇਹ ਮੈਂ ਇੱਦਾਂ ਦੀ ਬ ਬਾਹਵਾਂ ਪਾਉਣੀਆਂ ਜਾਂ ਗਲਾ ਪਾਉਣਾ ਬਾ ਫਿਰ ਅਸੀਂ ਓਨਲਾਈਨ ਆਪਣੇ ਯੂਟਿਊਬ 'ਤੇ ਉਹਨਾਂ ਦੇ ਡਿਜ਼ਾਇਨ ਦੇਖ ਕੇ ਅਤੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਤੇ ਹੋਟੋ ਗਰਮੀਆਂ ਦੇ ਵਿੱਚ ਜਿਹੜੇ ਪੀਸ ਸਾਡੇ ਬਚ ਜਾਂਦੇ ਨੇ ਸਲਾ ਸਿਲਾਈ ਨਈ ਦੇ ਵਿੱਚ ਦੇ ਕੱਪੜੇ ਬਚ ਜਾਂਦੇ ਆ ਉਹਨਾਂ ਦੇ ਅਸੀਂ ਛੋਟੇ ਛੋਟੀਆਂ ਡਰੈੱਸਾਂ ਤਿਆਰ ਕਰਕੇ ਅਸੀਂ ਉਹਨਾਂ ਨੂੰ ਮਤਬ ਕੀ ਵੇਚਦੇ ਆ ਲੋਕੀ ਕਾਫੀ ਡਿਮਾਂਡ ਕਰਦੇ ਆ ਵੀ ਅੱਛੇ ਅੱਛੇ ਡਰੈੱਸਾਂ ਮਤੇ ਕਿ ਬਣਾਈਆਂ ਜਾਣ ਅਤੇ ਅਸੀਂ ਉਹਨਾਂ ਨੂੰ ਛੋਟੀ ਛੋਟੀਆਂ ਡਰੈੱਸਾਂ ਵੀ ਮਤ ਠਾਕੁਰ ਜੀ ਦੇ ਜਿੰਨਾ ਮਤੇ ਕਿ ਸਾਈਜ਼ ਹੁੰਦਾ ਉਹਦੇ ਮੁਤਾਬਿਕ ਹੀ ਅਸੀਂ ਛੋਟੀ ਛੋਟੀਆਂ ਡਰੈੱਸਾਂ ਬਣਾ ਦਿੰਦੇ ਹਾਂ ਅਤੇ ਉਹ ਅਸੀਂ ਲੋਕਾਂ ਨੂੰ ਵੇਚਦੇ ਹਾਂ ਅਤੇ ਇਹ ਸਰਦੀਆਂ ਵਾਲੀਆਂ ਡਰੈੱਸਾਂ ਉਹਨਾਂ ਦੀ ਉੱਨ ਵਾਲੀਆਂ ਹੋ ਜਾਂਦੀਆਂ ਸਰਦ ਗਰਮੀਆਂ ਦੇ ਵਿੱਚ ਅਸੀਂ ਆਮ ਜਿਹੜੇ ਨਾਰਮਲ ਕੱਪੜੇ ਹੁੰਦੇ ਜਾਂ ਕੋਟਨ ਕੂਟਨ ਵਾਲੀਆਂ ਹੁੰਦੀਆਂ ਉਹਨਾਂ ਦੇ ਅਸੀਂ ਬਣਾ ਦਿੰਦੇ ਹਾਂ ਔਰ ਜ ਅੱਜ ਕੱਲ੍ਹ ਦੇ ਸੂਟ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਜ਼ਿਆਦਾਤਰ ਲੋਕ ਆਨਲਾਈਨ ਹੀ ਪਸੰਦ ਕਰਦੇ ਆ ਅਤੇ ਇਸ ਵਿੱਚ ਸਾਨੂੰ ਠਾਕੁਰ ਜੀ ਦੀਆਂ ਹੀ ਡਰੈੱਸਾਂ ਜ਼ਿਆਦਾ ਸਿਓਣੀਆਂ ਮੈਨੂੰ ਪਸੰਦ ਹੈਗੀਆਂ ਤੇ ਉਹਦੇ ਨਾਲ ਹੀ ਸਾਡਾ ਮਤਕਿ ਛੋਟ ਛੋਟੀਆਂ ਡਰੈੱਸਾਂ ਹੁੰਦੀਆਂ ਕਾਫੀ ਜਲਦੀ ਬਣ ਜਾਂਦੀਆਂ ਨੇ ਅਤੇ ਨਾ ਜ਼ਿਆਦਾ ਟਾਈਮ ਲੱਗਦਾ ਜੇ ਉਹਨ ਉਹਨਾਂ ਨੂੰ ਡੈਕੋਰੇਟ ਕਰਨਾ ਫਿਰ ਅਸੀਂ ਆਨਲਾਈਨ ਹੀ ਵੇਖ ਕੇ ਉਹਨਾਂ ਦੇ ਡਿਜ਼ਾਇਨ ਪਸੰਦ ਕਰੀ ਦਾ ਅਤੇ ਅਸੀਂ ਉਹਨਾਂ ਦੇ ਕਾਫੀ ਮਤਕਿ ਅੱਛੀ ਸੇਲ ਹੋ ਜਾਂਦੀ ਆ ਕਾਫੀ ਲੋਕ ਪਹਿਲਾਂ ਸਾਨੂੰ ਦੱਸ ਦਿੰਦੇ ਅੱਜ ਸਾਨੂੰ ਠਾਕੁ ਇੰਨੇ ਨੰਬਰ ਦੇ ਠਾਕੁਰ ਜੀ ਦੀ ਡਰੈੱਸ ਚਾਹੀਦੀ ਆ ਅਤੇ ਫਿਰ ਅਸੀਂ ਉਸ ਹਿਸਾਬ ਦੀਆਂ ਅਸੀਂ ਬਣਾ ਕੇ ਰੱਖ ਲੈਂਦੇ ਹਾਂ ਅਤੇ ਫਿਰ ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ ਇਸ ਤਰ੍ਹਾਂ ਹੀ ਮਾੜਾ ਮੋਟਾ ਗੁਜ਼ਾਰਾ ਚੱਲਦਾ ਰਹਿੰਦਾ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਕਿੰਨੀ ਮੰਹਿੰਗਾਈ ਦਾ ਦੌਰ ਆ ਅਤੇ ਘਰ ਦੀ ਜਨਾਨਾ ਨੂੰ ਥੋੜ੍ਹਾ ਬਹੁਤ ਪੈਸਾ ਇਕੱਠਾ ਕਰਨ ਦਾ ਥੋੜ੍ਹਾ ਮਿਲ ਜਾਂਦਾ ਮੌਕਾ ਅਤੇ ਕਈ ਜਗ੍ਹਾ 'ਤੇ ਪੈਸੇ ਇਸਤੇਮਾਲ ਕੀਤੇ ਜਾਂਦੇ ਆ ਆਪਣੇ ਹੱਥਾਂ ਦੀ ਮਿਹਨਤ ਦੇ ਨਾਲ ਹੀ ਅਸੀਂ ਆਪਣਾ ਬਿਜਨਸ ਵਧਾ ਵੀ ਸਕਦੇ ਹਾਂ